ਹਾਲਾਂਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਪਰ ਇਸਦੇ ਬਾਵਜੂਦ ਵੀ ਭਾਰਤ ਦੀ ਰਾਜਨੀਤੀ ਅਤੇ ਸਿਆਸੀ ਪਾਰਟੀਆਂ ਦਾ ਕੁਛ ਖਾਸ ਅੱਛਾ ਸਿਸਟਮ ਨਹੀਂ ਹੈ ਆਪਾਂ ਦੇਖਦੇ ਹਾਂ ਵੀ ਜੋ ਵੀ ਸਿਆਸੀ ਪਾਰਟੀਆਂ ਹਨ ਭਾਰਤ ਦੇ ਅੰਦਰ ਉਹਨਾਂ ਦੇ ਅੰਦਰ ਜੋ ਵੀ ਮੰਤਰੀ ਆਉਂਦੇ ਨੇ ਉਹ ਕੁਛ ਖਾਸ ਪੜ੍ਹੇ ਲਿਖੇ ਨਹੀਂ ਹੁੰਦੇ ਤਾਂ ਮੇਰਾ ਇਹ ਖਿਆਲ ਹੈ ਵੀ ਭਾਰਤ ਦੇ ਲੋਕਤੰਤਰ ਦੇ ਵਿੱਚ ਜੋ ਵੀ ਸਿਆਸੀ ਪਾਰਟੀਆਂ ਦੇ ਅੰਦਰ ਮੰਤਰੀ ਆਉਂਦੇ ਨੇ ਉਹ ਸਾਰੇ ਪੜ੍ਹੇ ਲਿਖੇ ਹੋਣੇ ਚਾਹੀਦੇ ਹਨ ਮੇਰਾ ਪਸੰਦੀਦਾ ਰਾਜਨੀਤਿਕ ਨੇਤਾ ਮਨਮੋਹਨ ਸਿੰਘ ਹੈ ਸ਼੍ਰੀ ਮਨਮੋਹਨ ਸਿੰਘ ਇੰਡੀਆ ਦੇ ਫਾਈਨਾਂਸ ਮਨਿਸਟਰ ਰਹੇ ਹਨ ਅਤੇ ਉਹਨਾਂ ਨੂੰ ਕਾਫ਼ੀ ਜ਼ਿਆਦਾ ਪੜ੍ਹੇ ਲਿਖੇ ਅਤੇ ਡਿਗਰੀ ਮਿਲੀ ਹੋਈ ਹੈ ਜਿਹਦੇ ਕਰਕੇ ਉਹਨਾਂ ਨੇ ਇੰਡੀਆ ਨੂੰ ਅੱਗੇ ਲੈ ਕੇ ਜਾਣ 'ਚ ਕਾਫ਼ੀ ਮਦਦ ਕੀਤੀ ਸੀ ਜੇਕਰ ਮੈਨੂੰ ਕਦੇ ਉਹਨਾਂ ਨੂੰ ਮਿਲਣ ਦੀ ਮੌਕਾ ਮਿਲਿਆ ਤਾਂ ਮੈਂ ਉਹਨਾਂ ਨੂੰ ਜ਼ਰੂਰ ਪੁੱਛਾਂਗੀ ਕਿ ਉਹ ਆਪਣੇ ਵਰਗੇ ਹੋਰ ਪੜ੍ਹੇ ਲਿਖੇ ਮੰਤਰੀ ਇੰਡੀਆ ਦੇ ਅੰਦਰ ਲੈ ਕੇ ਆਉਣ